ਮੈਂ ਅਰਪੀਤੋ ਆਰਟਸ ਜੋ ਕਿ ਆਪਣਾ ਜੋ ਕਿ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ ਅਤੇ ਆਪਣਾ ਅਪਾਰਟਮੈਂਟ ਖਾਲੀ ਕਰਨ ਜਾ ਰਿਹਾ ਹਾਂ ਅਤੇ ਜਿਸ ਲਈ ਮੈਨੂੰ ਮਕਾਨ ਮਾਲਕ ਤੋਂ ਸਿਕਿਉਰਟੀ ਵਾਪਸ ਲੈਣੀ ਹੈ ਅਤੇ ਉਹ ਮੀਟਰ ਰੀਡਿੰਗ ਦੇ ਕਾਰਨ ਰੁਕੀ ਹੋਈ ਹੈ ਮੈਂ ਆਪ ਜੀ ਤੋਂ ਬੇਨਤੀ ਕਰਨਾ ਹਾਂ ਕਿ ਆਪ ਆਪਣੇ ਅਧਿਕਾਰੀਆਂ ਨੂੰ ਭੇਜ ਕਰ ਮੇਰੇ ਮੀਟਰ ਦੀ ਰੀਡਿੰਗ ਲਈ ਜਾਵੇ ਅਤੇ ਜੋ ਬਿੱਲ ਬਣਦਾ ਹੈ ਉਹ ਮੈਨੂੰ ਦੱਸਿਆ ਜਾਵੇ ਤਾਂ ਜੋ ਉਹ ਬਿੱਲ ਭਰ ਕੇ ਮੈਂ ਮਕਾਨ ਮਾਲਿਕ ਤੋਂ ਆਪਣੇ ਸਿਕਿਉਰਟੀ ਨੂੰ ਵਾਪਸ ਲੈ ਸਕਾਂ ਅਤੇ ਆਪਣਾ ਅਪਾਰਟਮੈਂਟ ਛੱਡ ਕੇ ਦੂਜੇ ਅਪਾਰਟਮੈਂਟ ਵਿੱਚ ਸ਼ਿਫਟ ਕਰ ਸਕਾਂ ਅਤੇ ਜੋ ਮੈਂ ਮਕਾਨ ਮਾਲਕ ਨੂੰ ਸੁਰੱਖਿਆ ਦੇ ਤੌਰ 'ਤੇ ਜਮ੍ਹਾਂ ਕਰਵਾਈ ਸਿਕਿਉਰਿਟੀ ਹੈ ਉਸ ਨੂੰ ਵਾਪਸ ਲੈ ਸਕਾਂ ਆਪ ਜਲਦ ਤੋਂ ਜਲਦ ਆਪਣੇ ਅਧਿਕਾਰੀਆਂ ਨੂੰ ਭੇਜ ਕਰ ਮੇਰੀ ਮੀਟਰ ਰੀਡਿੰਗ ਲਿੱਤੀ ਜਾਵੇ ਅਤੇ ਮੇਰਾ ਬਣਦਾ ਬਿੱਲ ਮੈਨੂੰ ਦੱਸਿਆ ਜਾਵੇ ਤਾਂ ਜੋ ਉਸਨੂੰ ਮੈਂ ਸਮੇਂ 'ਤੇ ਪੇ ਕਰ ਸਕਾਂ ਮੇਰਾ ਅਕਾਊਂਟ ਨੰਬਰ ਚਾਰ ਦੋ ਤਿੰਨ ਚਾਰ ਛੇ ਸੱਤ ਅੱਠ ਹੈ ਧੰਨਵਾਦ